ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਮੇਰੀ ਗੱਲ ਓਲਾ ਵਾਲਿਆਂ ਨਾਲ ਹੋਣ ਡੀ ਆ ਓ ਹਾਂਜੀ ਭਾਅ ਜੀ ਤੁਹਾਡਾ ਲਾਸਟ ਟਾਈਮ ਨਾ ਮੈਂ ਤੁਹਾਡੀ ਇੱਕ ਕੈਬ ਬੁੱਕ ਕੀਤੀ ਸੀਗੀ ਗੱਡੀ ਨੰਬਰ ਸੀਗਾ ਆਪਣਾ ਪੀ ਬੀ ਜ਼ੀਰੋ ਟੂ ਚੌਦਾਂ ਅਤੇ ਇਕੱਤੀ ਤਾਂ ਜਿਹੜਾ ਤੁਹਾਡਾ ਡਰਾਈਵਰ ਸੀ ਨਾ ਜਸ਼ਨ ਜਸ਼ਨ ਨਾਮ ਸੀ ਸ਼ਾਇਦ ਹਾਂਜੀ ਉਹ ਨਾ ਕੀ ਇਹਦੇ ਨਾਂ ਲੈਂਦੇ ਉਹ ਨੇ ਉਹਨੇ ਨਾ ਪਤਾ ਕੀ ਕੀਤਾ ਕਿ ਮੈਨੂੰ ਪਹਿਲਾਂ ਤਾਂ ਮੈਂ ਜਲੰਧਰ ਤੋਂ ਇੱਥੋਂ ਅੰਮ੍ਰਿਤਸਰ ਦਿੱਲੀ ਕਲਾ ਕਿਰਾਇਆ ਅੰਮ੍ਰਿਤ ਤੋਂ ਅੰਮ੍ਰਿਤਸਰ ਤੋਂ ਜਲੰਧਰ ਕਿਰਾਇਆ ਬੁੱਕ ਕੀਤਾ ਸੀਗਾ ਕਿ ਹਜ਼ ਇੱਕ ਹਜ਼ਾਰ ਅਤੇ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਭਾਅ ਜੀ ਇਸ 'ਚ ਮੇਰੀ ਕੀ ਗਲਤੀ ਉਹ ਮੈਨੂੰ ਅੱਗੋਂ ਕਹਿ ਰਿਹਾ ਹੈ ਕਿ ਮੈਡਮ ਮੇਰਾ ਟ੍ਰੈਫਿਕ ਦੇ ਕਰਕੇ ਮੇਰੀ ਗੱਡੀ ਬੜੀ ਫੁਕੀ ਆ ਮੇਰਾ ਤੇਲ ਬਹੁਤ ਲੱਗਾ ਆ ਅਤੇ ਮੇ ਮੇਰੇ ਕੋਲੋਂ ਉਹ ਪੰਦਰਾਂ ਸੌਂ ਮੰਗਦਾ ਪਿਆ ਆ ਭਾਅ ਜੀ ਤੁਸੀਂ ਦੱਸੋ ਇਹ ਗੱਲ ਸਹੀ ਹੈ ਕਿ ਗਲਤ ਹੈ ਇੰਨਾ ਪੈ ਪੈਸਾ ਕੌਣ ਕਰਦਾ ਆ ਜਦੋਂ ਕਿ ਮੈਂ ਪੂਰੀ ਗੱਲ ਕਰਕੇ ਅਤੇ ਫਿਰ ਬੈਠੀ ਸੀਗੀ ਬੰਦਾ ਥੋੜ੍ਹਾ ਬਹੁਤ ਲਿਹਾਜ਼ ਕਰ ਲੈਂਦਾ ਆ ਗਾਹਕ ਜਿਹੜਾ ਹੁੰਦਾ ਉਹ ਆਪਣਾ ਰੱਬ ਦਾ ਰੂਪ ਹੁੰਦਾ ਆ ਅਤੇ ਉਸ ਤੋਂ ਬਾਅਦ ਉਹਦਾ ਬੋਲਣ ਦਾ ਥੋੜ੍ਹਾ ਜਿਹੜਾ ਵੇਅ ਸੀਗਾ ਨਾ ਮੈਨੂੰ ਉਹ ਵੀ ਨਹੀਂ ਸਹੀ ਲੱਗਿਆ ਉਹ ਬੰਦਾ ਥੋੜ੍ਹੇ ਤਰੀਕੇ ਨਾਲ ਗੱਲ ਕਰਦਾ ਆ ਉਹਨੇ ਇੰਨਾ ਵੀ ਲਿਹਾਜ਼ ਨਹੀਂ ਕੀਤਾ ਕਿ ਮੈਂ ਮਤਲਬ ਇੱਕ ਲੇਡੀ ਹਾਂ ਤਾਂ ਥੋੜ੍ਹਾ ਤਮੀਜ਼ ਨਾਲ ਗੱਲ ਕਰੇ ਅਤੇ ਭਾਅ ਜੀ ਮੈਂ ਸ਼ਿਕਾਇਤ ਨਹੀਂ ਕਰ ਰਹੀ ਬਸ ਮੈਂ ਤੁਹਾਨੂੰ ਅਲਰਟ ਕਰ ਰਹੀ ਹਾਂ ਤੁਸੀਂ ਉਸ ਬੰਦੇ ਨੂੰ ਸਮਝਾਓ ਚਲੋ ਠੀਕ ਹੈ ਜੀ ਅੱਗੇ ਤੋਂ ਥੋੜ੍ਹਾ ਧਿਆਨ ਰੱਖਿਓ ਚਲੋ ਠੀ ਚੰਗਾ ਜੀ ਸ਼ਾਸ਼ੀ